ਮੈਂ ਫਿਲਮਾਂ ਦੇਖਣਾ ਜ਼ਿਆਦਾ ਪਸੰਦ ਨਹੀਂ ਕਰਦੀ ਇਸ ਲਈ ਮੈਨੂੰ ਇਹਨਾਂ ਦੇ ਕਿਸੇ ਵੀ ਪਹਿਰਾਵੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ